ਅਲਟੋ ਅੱਠ ਸੌ ਸਵਿਫਟ ਡਿਜ਼ਾਇਰ ਬਲੇਨੋ ਬਰੇਜਾ ਨਕਸਾਨ ਸਫਾਰੀ ਹੈਰੀਅਰ ਟਿਆਗੋ ਥਾਰ ਸਕਾਰਪੀਓ ਬਿਲੇਰੋ ਐਕਸਯੂਵੀ ਸੱਤ ਸੌ ਕਰੇਟਾ ਆਈ ਟਵੰਨਟੀ ਵਰਨਾ ਸੈਲਟਸ ਸੋਨਟ ਫਾਰਚੂਨਰ ਇਨੋਵਾ ਸੀਟੀ ਅਮੀਸ ਅੰਡੈਵਰ ਮੈਗਨਾਈਸ ਕਰੇਨਸ ਜੀਮਨੀ ਹੈਕਬੈਕ ਗਲਾਂਜਾ ਐਕਸ ਐਕਸਪਰੋਟ ਕਵਿੱਡ ਸਪਲੈਂਡਰ ਪਲੱਸ ਪੈਸ਼ਨ ਪਰੋ ਗਲੈਮਰ ਐਕਸ ਪਲੱਸ ਟਵੰਨਟੀ ਪਲਸਰ ਪਲਸਰ ਐਨ ਡੈਮੀਨਾਰ ਡੋਮੀਨਾਰ ਕਲਾਸਿਕ ਹੰਟਰ ਮੀਟੀਓਰ ਆਰ ਫਾਈਵ ਵਨ ਮਟੀ ਵਨ ਫਾਈਵ ਵੀ ਟੂ ਅਪਾਚੇ ਸਿਕਸਚਰ ਐਕਟਿਵਾ ਜੁਪੀਟਰ ਨਟਰ ਮਾਇਸ ਮਾਇਸਟੋ ਦੀਓ ਐ ਐਵੀਏਟਰ ਅਪਾ ਅਪਾਚੇ ਸਵਰਾਜ ਮੈਸੀ ਮਹਿੰਦਰਾ ਜੋਨਡੀਅਰ ਫੀਫਟੀ ਫੀਫਟੀ ਪ੍ਰੀਤ ਸਿਕਸ ਸਿਕਸਟੀ ਫੋਰਟੀ ਨਾਈਨ ਸੋਨਾਲੀਕਾ ਡੀਆਈ ਸੱਤ ਸੌ ਪੰਜਾਹ ਇੰਟਰਨੈਸ਼ਨਲ ਅਠਤਾਲੀ ਚਾਲੀ ਆਦੀ ਧੰਨਵਾਦ